ਜੀ ਬਿਲਕੁਲ ਭੰਗੜਾ ਅਤੇ ਆਰੋਬਿਕਸ ਸਰੀਰ ਲਈ ਬਹੁਤ ਵਧੀਆ ਹੁੰਦੇ ਹਨ ਉਹਦੇ ਨਾਲ ਸਾਡਾ ਪੂਰਾ ਸਰੀਰ ਹਿਲਦਾ ਹੈ ਜਦੋਂ ਅਸੀਂ ਕਰਦੇ ਹਾਂ ਸਾਡੀ ਤਰ੍ਹਾਂ ਦੀ ਐਕਸਰਸਾਈਜ਼ ਵੀ ਹੁੰਦੀ ਆ ਭੰਗੜਾ ਕਰਨ ਨਾਲ ਸਾਡਾ ਪੂਰਾ ਸਰੀਰ ਹਿੱਲਦਾ ਹੈ ਜਦੋਂ ਉਹਦੇ ਵਿੱਚ ਉਡਾਰੀਆਂ ਮਾਰਦੇ ਆ ਸਾਡੇ ਪੂਰੇ ਬਾਹਵਾਂ ਦੀਆਂ ਲੱਤਾਂ ਦੀ ਕਮਰ ਦੀ ਪੇਟ ਦੀ ਹਰ ਇੱਕ ਚੀਜ਼ ਦੀ ਸਾਡੇ ਐਕਸਾਈਜ਼ ਉਹਦੇ ਨਾਲ ਕਿ ਹੋ ਜਾਂਦੀ ਹੈ ਅਤੇ ਐਰੋਬਿਕਸ ਦਾ ਵੈਸੇ ਹੀ ਸਰੀਰ ਲਈ ਬਹੁਤ ਵਧੀਆ ਹੈ ਜਦੋਂ ਜਿੱਦਾਂ ਜਿੱਦਾਂ ਸਾਡਾ ਸਰੀਰ ਹਿੱਲੇਗਾ ਸਾਡੇ ਸਰੀਰ ਸਾਡੇ ਸ਼ਰੀਰ ਦਾ ਹਿੱਲਣਾ ਹੀ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਨੱਚਦੇ ਹਾਂ ਗਉਂਦੇ ਹਾਂ ਕੁਛ ਵੀ ਕਰਦੇ ਹਾਂ ਤਾਂ ਸਾਡਾ ਸਰੀਰ ਹਿੱਲਨ ਦੇ ਨਾਲ ਉਹ ਹਰ ਇੱਕ ਚੀਜ਼ ਵਧੀਆ ਹੋ ਜਾਂਦੀ ਹੈ ਸਾਡਾ ਸਰੀਰ ਖੁਲ੍ਹਦਾ ਹੈ ਇਹ ਚੀਜ਼ਾਂ ਕਰਨ ਦੇ ਨਾਲ ਅਤੇ ਭੰਗੜਾ ਕਰਨ ਇੱਕ ਤਾਂ ਬੰਦਾ ਕੋਈ ਵੀ ਗਾਣਾ ਲਗਾ ਕੇ ਆਰਾਮ ਨਾਲ ਆਪਣਾ ਡਾਂਸ ਕਰ ਸਕਦਾ ਹੈ ਐਰੋਬਿਕ ਅਸੀਂ ਜਿਵੇਂ ਜਿੰਮ ਵਿੱਚ ਵੀ ਸਾ ਕਰਵਾਏ ਜਾਂਦੇ ਹਨ ਐਰੋਬਿਕਸ ਨਾਲ ਵੀ ਬੰਦਾ ਮਾਈਂਡ ਦਿਮਾਗ ਬਿਲਕੁਲ ਸਾਡਾ ਫਰੈੱਸ਼ ਹੋ ਜਾਂਦਾ ਹੈ ਜਦੋਂ ਅਸੀਂ ਘੰਟੇ ਲਈ ਆਪਣੇ ਘਰੋਂ ਜਾਂਦੇ ਹਾਂ ਜਿੰਮ ਵਿੱਚ ਜਾਈਏ ਜਾਂ ਯੋਗਾ ਕਰਨ ਜਾਈਏ ਕਿਤੇ ਵੀ ਜਾਈਏ ਉੱਥੇ ਕਰੀਏ ਐਰੋਬਿਕਸ ਕਰੀਏ ਭੰਗੜਾ ਕਰੀਏ ਜੁੰਬਾ ਕਰੀਏ ਕੁਛ ਵੀ ਜਦੋਂ ਸਾਡਾ ਸਰੀਰ ਹਿੱਲੇਗਾ ਜੋ ਸਾਨੂੰ ਖੁਸ਼ੀ ਦਿੰਦਾ ਹੈ ਜੋ ਸਾਡੇ ਸਰੀਰ ਨੂੰ ਜਦੋਂ ਅਸੀਂ ਉਹ ਚੀਜ਼ ਕਰਦੇ ਹਾਂ ਤਾਂ ਸਾਡਾ ਮਾਈਂਡ ਫਰੈੱਸ਼ ਹੋ ਜਾਂਦਾ ਹੈ ਅਤੇ ਖੂਨ ਦੀ ਵੀ ਗਤੀਵਿਧੀ ਇਹਦੇ ਨਾਲ ਬਹੁਤ ਜ਼ਿਆਦਾ ਵਧਦੀ ਹੈ ਜਿਸ ਕਾਰਨ ਸਾਨੂੰ ਲੋਕਾਂ ਕੋਲ ਜਿਸ ਨਾਲ ਅਸੀਂ ਖੁਸ਼ ਰਹਿੰਦੇ ਹਾਂ ਸਾਡਾ ਦਿਮਾਗ ਵੀ ਸ਼ਾਂਤ ਰਹਿੰਦਾ ਹੈ ਅਸੀਂ ਬੱਚਿਆਂ ਨੂੰ ਵੀ ਵਧੀਆ ਤਰੀਕੇ ਨਾਲ ਪੜ੍ਹਾ ਸਕਦੇ ਹਾਂ ਅਤੇ ਜਦੋਂ ਵੀ ਅਸੀਂ ਇੱਦਾਂ ਕਰਦੇ ਹਾਂ ਅਸੀਂ ਬੱਚਿਆਂ ਨੂੰ ਵੀ ਕਰ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਇਹ ਚੀਜ਼ਾਂ ਕਰਨ ਮੈਂ ਮੈਨੂੰ ਇਹੀ ਹੁੰਦਾ ਹੈ ਕਿ ਮੇਰਾ ਮੁੰਡਾ ਇੱਕ ਛੋਟਾ ਅੱਠ ਸਾਲ ਦਾ ਉਹ ਹਮੇਸ਼ਾ ਮੇਰੇ ਨਾਲ ਜਦੋਂ ਮੈਂ ਭੰਗੜਾ ਕਰਦੀ ਹਾਂ ਅਸੀਂ ਦੋਨੋਂ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਾਂ ਉਹ ਵੀ ਖੁਸ਼ ਹੁੰਦਾ ਹੈ ਅਤੇ ਮੈਂ ਵੀ ਖੁਸ਼ ਹੁੰਦੀ ਹਾਂ